ਹੈਲੋ ਹਾਂਜੀ ਮੈਂ ਚੰਡੀਗੜ੍ਹ ਤੋਂ ਬੋਲਦੀ ਸੀਗੀ ਅਸੀਂ ਦਿੱਲੀ ਨੂੰ ਜਾਣਾ ਸੀਗਾ ਜੀ ਇੱਥੇ ਤੁਹਾਡੀ ਕੈਬ ਨੂੰ ਅਸੀਂ ਕਾਫੀ ਦੇਰ ਦਾ ਅਸੀਂ ਔਨਲਾਈਨ ਬੁੱਕ ਕਰੀ ਸੀ ਤੁਹਾਡਾ ਕੈਬ ਵਾਲਾ ਡਰਾਈਵਰ ਇੱਥੇ ਪਹੁੰਚਿਆ ਨਹੀਂ ਹੈਗਾ ਸਾਡੀ ਫਲੈਟ ਜਿਹੜੀ ਉਹ ਖੁੰਝ ਗਈ ਅਸੀਂ ਕਾਫੀ ਦੇਰ ਤੋਂ ਇੱਥੇ ਖੜ੍ਹੇ ਸੀ ਅਤੇ ਮੇਰਾ ਮਤਲਬ ਹੁਣ ਤੁਸੀਂ ਮ ਜਿਹੜਾ ਮ ਪੈਸੇ ਵਗੈਰਾ ਉਹ ਰੀਫੰਡ ਕਰੋ ਅਤੇ ਨਹੀਂ ਫਿਰ ਮੈਂ ਇਹਨਾਂ ਦੀ ਸ਼ਿਕਾਇਤ ਕਰਕੇ ਆਊਂਗੀ ਏਜੰਸੀ ਦੇ ਵਿੱਚ ਇੱਥੇ ਅਸੀਂ ਕਾਫੀ ਦੇਰ ਦੇ ਬੱਚਿਆਂ ਦੇ ਨਾਲ ਖੜ੍ਹੇ ਹਾਂ ਸਾਡਾ ਕਿੰਨਾ ਟਾਈਮ ਵੇਸਟ ਹੋਇਆ ਬਹੁਤ ਗਲਤ ਗੱਲ ਕਰੀ ਹੈ ਤੁਹਾਡੇ ਆਟੋ ਵਾਲੇ ਨੇ ਤੁਸੀਂ ਏਜੰਸੀ ਵਾਲਿਆਂ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ